ਹੁਣ ਦੇ ਸਮੇਂ ਦੀ ਗੱਲ ਕਰੀਏ ਤਾਂ ਬੁਣਾਈ ਵਾਲੀਆਂ ਚੀਜ਼ਾਂ ਕੋਈ ਪਾਉਣਾ ਪਸੰਦ ਨਹੀਂ ਕਰਦਾ ਪੁਰਾਣੇ ਸਮਿਆਂ ਦੀ ਗੱਲ ਕਰੀਏ ਤਾਂ ਪੁਰਾਣੇ ਸਮਿਆਂ ਵਿੱਚ ਦਾਦੀਆਂ ਅਤੇ ਨਾਨੀਆਂ ਆਪਣੇ ਬੱਚਿਆਂ ਨੂੰ ਕੋਟੀਆਂ ਅਤੇ ਸਵੈਟਰ ਬੁਣ ਕੇ ਦਿੰਦੇ ਸੀ ਅਤੇ ਬੱਚੇ ਬਹੁਤ ਹੀ ਖੁਸ਼ ਹੋ ਕੇ ਪਾਉਂਦੇ ਸੀ ਹੁਣ ਦੇ ਸਮੇਂ ਦੀ ਗੱਲ ਕਰੀਏ ਤਾਂ ਹੁਣ ਬੁਣਾਈ ਵਾਲੇ ਕੱਪੜੇ ਦਾ ਕੋਈ ਪਾਉਣਾ ਪਸੰਦ ਹੀ ਨਹੀਂ ਕਰਦਾ ਕਿਉਂਕਿ ਬੁਣਾਈ ਹੀ ਇੰਨੀ ਜ਼ਿਆਦਾ ਮਹਿੰਗੀ ਹੋ ਗਈ ਹੈ ਹਰੇਕ ਕੋਈ ਖਰੀਦ ਨਹੀਂ ਸਕਦਾ ਹੁਣ ਤਾਂ ਰੈਡੀਮੇਟ ਸੂਟਾਂ ਦਾ ਰਿਵਾਜ਼ ਹੋ ਗਿਆ ਹੈ ਰੈਡੀਮੇਡ ਸੂਟਾਂ ਵਿੱਚ ਜਿਵੇਂ ਕਿ ਪਲਾਜੋ ਸੂਟ ਸਲਵਾਰ ਸੂਟ ਸਿੰਪਲ ਸੂਟ ਆਦਿ ਹੁੰਦੇ ਹਨ ਉਹਨਾਂ ਵਿੱਚ ਕਿਸੇ ਦਾ ਗਲ਼ਾ ਵੱਡਾ ਕੋਈ ਛੋਟਾ ਕੋਈ ਡੀਫ ਗਲ਼ਾ ਹੁੰਦਾ ਹੈ ਅਤੇ ਇਹੀ ਸੂਟ ਪਾਉਣਾ ਪਸੰਦ ਕਰਦੇ ਹਨ